ਜਾਨਵਰ ਉਤਪਾਦ ਦੀ ਪ੍ਰੋਸੈਸਿੰਗ ਜੋ ਉਹ ਅੰਤਿਮ ਉਤਪਾਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੀ ਕਰਦੀ ਹੈ ਕਿਉਂਕਿ ਦੇਖੋ ਜੇਕਰ ਆਪਾਂ ਮੀਟ ਦੀ ਗੱਲ ਕਰ ਲਈਏ ਜੇਕਰ ਜਿਸ ਜਾਨਵਰ ਦਾ ਵੀ ਮੀਟ ਚੱਲ ਰਿਹਾ ਜਿੱਦਾਂ ਬੱਕਰੀ ਦਾ ਮੀਟ ਕਹਿ ਲਓ ਬੱਕਰਾ ਕਹਿ ਲਓ ਬੱਕਰੇ ਦਾ ਮੀਟ ਚੱਲ ਰਿਹਾ ਤਾਂ ਜੇਕਰ ਉਹ ਬੱਕਰਾ ਸ਼ੁਰੂ ਤੋਂ ਚੰਗੀ ਖੁਰਾਕ ਚੰਗੇ ਹਰੇ ਚਾਰੇ ਚੰਗੀ ਫੀਡ ਨਾਲ ਉਹਦਾ ਪਾਲਣ ਪੋਸ਼ਣ ਕਰਿਆ ਹੋਵੇਗਾ ਤਾਂ ਜੋ ਜੋ ਉਹਦਾ ਅੰਤਿਮ ਉਤਪਾਦ ਹੋਵੇਗਾ ਜੋ ਉਸ ਦਾ ਮੀਟ ਹੋਵੇਗਾ ਉਸ ਦੀ ਗੁਣਵੱਤਾ ਜੋ ਉਹ ਵੀ ਉੱਚੀ ਹੋਵੇਗੀ ਪਰ ਜੇਕਰ ਉਸੇ ਹੀ ਬੱਕਰੇ ਨੂੰ ਦਾ ਪਾਲਣ ਪੋਸ਼ਣ ਦੀ ਗੱਲ ਕਰ ਲਈਏ ਸਹੀ ਤਰੀਕੇ ਨਾਲ ਨਾ ਹੋਇਆ ਹੋਵੇ ਤਾਂ ਜੋ ਉਸ ਦਾ ਅੰਤਿਮ ਉਤਪਾਦ ਹੋਵੇਗਾ ਜਾਂ ਅੰਤ ਦੇ ਵਿੱਚ ਜੋ ਉਸ ਦਾ ਮੀਟ ਹੋਵੇਗਾ ਉਸ ਦੀ ਗੁਣਵੱਤਾ ਹੋਵੇਗੀ ਜੋ ਜੋ ਬਹੁਤ ਹੀ ਘੱਟ ਹੋਵੇਗੀ ਸੋ ਜਾਨਵਰ ਨੂੰ ਖਰੀਦਣ ਤੋਂ ਲੈ ਕੇ ਅਖੀਰ ਪ੍ਰਕਿਰਿਆ ਤੱਕ ਜਾਨਵਰ ਦਾ ਜੋ ਪਾਲਣ ਪੋਸ਼ਣ ਆ ਜੋ ਉਸ ਦਾ ਹਰਾ ਚਾਰਾ ਜੋ ਉਸ ਦੀ ਸਿਹਤ ਆ ਉਸ ਦੀ ਸਾਂਭ ਸੰਭਾਲ ਆ ਇਹ ਇਸ ਪੂਰੀ ਪ੍ਰਕਿਰਿਆ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਉਦਾਂ ਹੀ ਦੇਖ ਲਈਏ ਨਾ ਆਪਾਂ ਜੇਕਰ ਜਾਨਵਰ ਦੀ ਸਿਹਤ ਚੰਗੀ ਹੋਵੇਗੀ ਤਾਂ ਉਹ ਅੰਤ ਵਿੱਚ ਸਾਨੂੰ ਪੈਸੇ ਚੰਗੇ ਦੇ ਕੇ ਜਾਵੇਗਾ ਜੇਕਰ ਜਾਨਵਰ ਦੀ ਸਿਹਤ ਹੀ ਮਾੜੀ ਆ ਜਿਸ ਦਾ ਉਹ ਜਿਸ ਤੋਂ ਅਸੀਂ ਕੋਈ ਅੰਤਿਮ ਉਤਪਾਦ ਲੈਣਾ ਕੋਈ ਮੀਟ ਲੈਣਾ ਜਾਂ ਫਿਰ ਕਈ ਜਾਨਵਰਾਂ ਤੋਂ ਚਮੜਾ ਪ੍ਰਾਪਤ ਕਰਦੇ ਹਾਂ ਤਾਂ ਫਿਰ ਉਹ ਉਸ ਦਾ ਜੋ ਉਤਪਾਤ ਹੋਵੇਗਾ ਉਹ ਵੀ ਮਾੜਾ ਹੀ ਹੋਵੇਗਾ